ਹੈਲੋ ਸੇਤੀਆ ਰੈਸਟੋਰੈਂਟ ਤੋਂ ਬੋਲ ਰਹੇ ਹੋ ਜੀ ਮੈਂ ਤੁਹਾਡੇ ਕੋਲੋਂ ਖਾਣ ਪੀਣ ਦਾ ਆਰਡਰ ਕਰਦਾ ਰਹਿੰਦਾ ਹਾਂ ਮੇਰਾ ਐਡਰੈਸ ਤੁਹਾਡੇ ਕੋਲ ਫੀਡ ਹੈ ਜੀ ਤੁਹਾਡਾ ਖਾਣਾ ਤੇ ਬਹੁਤ ਵਧੀਆ ਹੁੰਦਾ ਹੈ ਜੀ ਅਤੇ ਅੱਜ ਮੈਂ ਕਿਸੇ ਹੋਰ ਜਗ੍ਹਾ 'ਤੇ ਬੈਠਾ ਹਾਂ ਮੈਂ ਖਾਣਾ ਆਰਡਰ ਕਰਨਾ ਹੈ ਜੀ ਅਤੇ ਇਸ ਕਰਕੇ ਕੋਈ ਹੋਰ ਪ੍ਰੋਸੀਜ਼ਰ ਦੱਸੋ ਜੋ ਕੀ ਮੇਰੇ ਕੋਲ ਖਾਣਾ ਪਹੁੰਚ ਜਾਵੇ ਅੱਜ ਮੈਂ ਕਿਸੇ ਹੋਰ ਜਗ੍ਹਾ 'ਤੇ ਬੈਠਾ ਹਾਂ ਤੁਹਾਡਾ ਖਾਣਾ ਬਹੁਤ ਵਧੀਆ ਹੁੰਦਾ ਹੈ ਜੀ ਇਸ ਕਰਕੇ ਮੈਨੂੰ ਕੋਈ ਦੱਸੋ ਵੀ ਜੇ ਇਸ ਤਰ੍ਹਾਂ ਮੇਰੇ ਕੋਲ ਮੇਰਾ ਆਰਡਰ ਪਹੁੰਚ ਗਏ ਕੋਈ ਪ੍ਰੋਸੀਜ਼ਰ ਹੋਵੇ ਜਾਂ ਕੁਛ ਹੋਰ ਵੀ ਹੋਵੇ ਤਾਂ ਦੱਸੋ ਤੁਹਾਡਾ ਖਾਣਾ ਬਹੁਤ ਵਧੀਆ ਹੁੰਦਾ ਐ ਮੈਂ ਅੱਗੇ ਵੀ ਕਈ ਵਾਰ ਤੁਹਾਡੇ ਕੋਲ ਖਾਣਾ ਆਰਡਰ ਕੀਤਾ ਹੈ ਤੇ ਅੱਜ ਮੈਨੂੰ ਇਹ ਮੁਸ਼ਕਿਲ ਆਉਂਦੀ ਪਈ ਆ ਮੈਂ ਕਿਤੇ ਹੋਰ ਜਗ੍ਹਾ 'ਤੇ ਬੈਠਾ ਜੋ ਕਿ ਮੇਰੇ ਕੋਲ ਆਰਡਰ ਪਹੁੰਚਾਉਣ ਵਾਸਤੇ ਕੋਈ ਨਾ ਕੋਈ ਪ੍ਰੋਸੀਜ਼ਰ ਦੱਸੋ ਜਾ ਕੁਛ ਵੀ ਦੱਸੋ ਤੁਸੀਂ ਓਨਰ ਬੋਲ ਰਹੇ ਹੋ ਮੈਂ ਸਵੀਗੀ 'ਤੇ ਆ ਜਮੈਟੋ 'ਤੇ ਵੀ ਆਰਡਰ ਕਰਦਾ ਰਹਿਣਾ ਹਾਂ ਤੁਹਾਡਾ ਖਾਣ ਬਹੁਤ ਵਧੀਆ ਹੁੰਦਾ ਹੈ ਇਸ ਕਰਕੇ ਮੈਨੂੰ ਕੋਈ ਸਲਿਊਸ਼ਨ ਦੱਸੋ